ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਪ੍ਰੀਤ ਮੋਬਾਈਲ ਸ਼ੋਪ ਤੋਂ ਬੋਲ ਰਹੇ ਹੋ ਹਾਂਜੀ ਅਸੀਂ ਤੁਹਾਡੇ ਕੋਲੋਂ ਆਪਣਾ ਇੱਕ ਫੋਨ ਹੈ ਜੋ ਅਸੀਂ ਤੁਹਾਡੇ ਕੋਲੋਂ ਮਤਲਬ ਡਿਲੀਵਰ ਕੀਤਾ ਸੀ ਤੁਸੀਂ ਸਾਨੂੰ ਅਸੀਂ ਔਡਰ ਦੇਆ ਸੀ ਹਾਂਜੀ ਉਹ ਮੇਰੇ ਕੋਲ ਸ ਬਿਲਕੁਲ ਵਧੀਆ ਤਰੀਕੇ ਨਾਲ ਡਿਲੀਵਰ ਹੋ ਚੁੱਕਿਆ ਹੈ ਉਹਦੀ ਪੈਕਜਿੰਗ ਬਹੁਤ ਵਧੀਆ ਸੀ ਹਾਂਜੀ ਅਤੇ ਜੋ ਫੋਟੋ ਨਾਲੋਂ ਅਸਲ ਦੇ ਵਿੱਚ ਫੋਨ ਆ ਉਹ ਉਹਦੀ ਕੁਆਲਿਟੀ ਬਹੁਤ ਵਧੀਆ ਆ ਅਤੇ ਟੱਚ ਵੀ ਉਹਦੀ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਵਧੀਆ ਕੁਆਲਿਟੀ ਦਾ ਫੋਨ ਤੁਸੀਂ ਭੇਜਿਆ ਆ ਹਾਂਜੀ ਅਤੇ ਉਹਦੀ ਜੋ ਬੈਟਰੀ ਬੈਕਅਪ ਹੈ ਉਹ ਵੀ ਬਹੁਤ ਵਧੀਆ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾਂ ਵਧੀਆ ਔਡਰ ਦੇਣ ਤੁਸੀਂ ਡਿਲੀਵਰ ਕਰਿਆ ਅਤੇ ਅੱਗੋਂ ਜਦੋਂ ਸਾਨੂੰ ਲੋੜ ਪਊਂਗੀ ਤਾਂ ਮੈਂ ਤੁਹਾਡੇ ਕੋਲੋਂ ਦੁਬਾਰਾ ਇਹੀ ਸੇਮ ਮੋਡਲ ਜਾਂ ਫਿਰ ਕੋਈ ਹੋਰ ਫੋਨ ਔਡਰ ਕਰਨਾ ਪਸੰਦ ਕਰਾਂਗੀ ਧੰਨਵਾਦ ਜੀ